ਜੀ ਹਾਂ ਯੋਗਾ ਇੱਕ ਐਸੀ ਚੀਜ਼ ਹੈ ਜਿਸ ਨੂੰ ਸਿੱਖਣ ਲਈ ਤੁਹਾਨੂੰ ਕੋਈ ਨਾ ਕੋਈ ਚੈਨਲ ਚਾਹੀਦਾ ਹੈ ਅੱਜ ਕੱਲ੍ਹ ਤਾਂ ਟੈਕਨੋਲੋਜੀ ਦਾ ਸਮਾਂ ਹੈ ਤੁਸੀਂ ਚੈਨਲ ਟੀਵੀ 'ਤੇ ਵੀ ਵੇਖ ਸਕਦੇ ਹੋ ਅਤੇ ਫੋਨ 'ਤੇ ਵੀ ਵੇਖ ਸਕਦੇ ਹੋ ਅਸੀਂ ਅਲੱਗ ਅਲੱਗ ਯੋਗਾ ਵਾਸਤੇ ਅਲੱਗ ਅਲੱਗ ਆਸਨ ਹੁੰਦੇ ਹਨ ਤੁਸੀਂ ਹਰ ਇੱਕ ਆਸਨ ਕਰ ਸਕਦੇ ਹੋ ਜਿਸ ਨਾਲ ਤੁਹਾਡੀ ਮਾਨਸਿਕ ਅਤੇ ਸਰੀਰਿਕ ਜਿਹੜੀ ਤੁਹਾਡੀ ਉਹ ਵੈਲਿਊ ਹੈ ਉਹ ਵੱਧ ਜਾਏਗੀ ਯੋਗਾ ਇੱਕ ਐਸੀ ਚੀਜ਼ ਹੈ ਜਿਸ ਤੁਸੀਂ ਆਰਾਮ ਨਾਲ ਸਬਰ ਨਾਲ ਸਿੱਖ ਸਕਦੇ ਹੋ ਲੋਕਾਂ ਨੂੰ ਕਿਹੜੀਆਂ ਮੁਸ਼ਕਿਲਾਂ ਸਾਮਨਾ ਕਰਦੇ ਹਨ

ਮੁਸ਼ਕਿਲਾਂ ਯੋਗਾ ਕਰਨ ਵੇਲੇ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ ਕਿਉਂਕਿ ਜੇਕਰ ਅਸੀਂ ਗਲਤ ਆਸਨ ਕਰਦੇ ਹਾਂ ਤਾਂ ਸਾਨੂੰ ਥੋੜ੍ਹੇ ਨੁਕਸਾਨ ਵੀ ਹੋ ਸਕਦੇ ਹਨ ਯੋਗਾ ਇੱਕ ਐਸੀ ਚੀਜ਼ ਹੈ ਜਿਸ ਦੇ ਨੁਕਸਾਨ ਤਾਂ ਹੈ ਪਰ ਲਾਭ ਵੀ ਬਹੁਤ ਹਨ ਸਾਨੂੰ ਆਰਾਮ ਨਾ ਸਾਨੂੰ ਯੋਗਾ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਮਾਨਸਿਕ ਜੀਵਨ ਠੀਕ ਰਹੇ ਸਾਨੂੰ ਯੋਗਾ ਆਰਾਮ ਨਾਲ ਬੈਠ ਕੇ ਕਰਨਾ ਚਾਹੀਦਾ ਹੈ ਅਤੇ ਕਿਸੇ ਕੋਲ ਵੇਖ ਕੇ ਸਿੱਖ ਕੇ ਫਿਰ ਕਰਨਾ ਚਾਹੀਦਾ ਹੈ ਸਾਨੂੰ ਯੋਗਾ ਜਾਂ ਕੋਈ ਚੈਨਲ ਤੋਂ ਜਾਂ ਕਿਸੇ ਹੋਰ ਮਾਧਿਅਮ ਤੋਂ ਸਿੱਖ ਕੇ ਬਿਨਾਂ ਕਿਸੇ ਮੁਸ਼ਕਿਲ ਦੇ ਕਰਨਾ ਚਾਹੀਦਾ ਹੈ ਅਤੇ ਸਾਨੂੰ ਯੋਗਾ ਸਿੱਖਣ ਵੇਲੇ ਮੁਸੀਬਤ ਪ ਮੁਸ਼ਕਿਲਾਂ ਵੀ ਆ ਸਕਦੀਆਂ ਹਨ ਜਿਵੇਂ ਜਿਵੇਂ ਕਿ ਸਾਨੂੰ ਸ਼ੁਰੂ 'ਚ ਇਹ ਨਹੀਂ ਪਤਾ ਚਲੇਗਾ ਕਿ ਸਾਨੂੰ ਕਿਹੜਾ ਹੱਥ ਕਿੱਥੇ ਰੱਖਣਾ ਹੈ ਕਿਹੜਾ ਪੈਰ ਕਿੱਥੇ ਰੱਖਣਾ ਹੈ ਕਿਹੜਾ ਐਂਗਲ ਕਿੱਦਾਂ ਬਣਾਉਣਾ ਹੈ ਹਰ ਇੱਕ ਚੀਜ਼ ਅਲੱਗ ਅਲੱਗ ਹੈ ਧੰਨਵਾਦ